ਪਾਣੀ ਦੀ ਲੋੜ ਸਾਨੂੰ ਕਿਤੇ ਕਿਤੇ ਨਹੀਂ ਪੈਂਦੀ ਹੈ ਸਵੇਰੇ ਉ ਦਿਨਚਰਆ ਦੁਕਾ ਦੌਰਾਨ ਜਦੋਂ ਆਪਾਂ ਉੱਠਦੇ ਹੀ ਹਾਂ ਤਦ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਆਪਾਂ ਪਾਣੀ ਪੀਂਦੇ ਹਾਂ ਉਸ ਤੋਂ ਸ ਬਾਅਦ ਸਾਨੂੰ ਬਰੱਸ਼ ਕਰਨ ਦੀ ਲਈ ਪਾਣੀ ਦੀ ਲੋੜ ਪੈਂਦੀ ਹੈ ਫਿਰ ਨਹਾਉਣ ਲਈ ਪਾਣੀ ਦੀ ਲੋੜ ਪੈਂਦੀ ਹੈ ਘਰ ਦੇ ਸੌ ਕੰਮ ਲਈ ਪਾਣੀ ਦੀ ਲੋੜ ਪੈਂਦੀ ਹੈ ਪਾਣੀ ਦੀ ਜ਼ਰੂਰਤ ਹਰ ਜਗ੍ਹਾ ਸਾਨੂੰ ਪੈਂਦੀ ਹੈ ਚਾਹੇ ਉਹ ਭਾਂਡੇ ਮਾਂਜਣ ਹੋਵੇ ਰੋਟੀ ਬਣਾਉਣ ਵੇਲੇ ਹੋਵੇ ਜਾਂ ਕੱਪੜੇ ਧੋਣ ਵੇਲੇ ਹੋਵੇ ਪਾਣੀ ਦੀ ਲੋੜ ਸਾਨੂੰ ਹਰ ਜਗ੍ਹਾ ਪੈਂਦੀ ਹੈ ਉਸ ਤੋਂ ਬਾਅਦ ਅਸੀਂ ਨਹਾਉਣਾ ਧੋਣਾ ਕੰਮ ਕਰਨਾ ਹਰ ਕੰਮ ਲਈ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਚਾਹੇ ਬੂਟਿਆਂ ਨੂੰ ਪਾਣੀ ਪਾਉਣਾ ਹੋਵੇ ਚਾਹੇ ਘਰ ਵਿੱਚ ਪੋਚੇ ਲਾਉਣੇ ਹੋਣ ਚਾਹੇ ਚਾਹੇ ਰੋਟੀ ਬਣਾਉਣੀ ਹੋਵੇ ਸਬਜ਼ੀ ਬਣਾਉਣੀ ਹੋਵੇ ਜੋ ਵੀ ਉਹਦੇ ਵਿੱਚ ਵੀ ਸਾਨੂੰ ਪਾਣੀ ਦੀ ਲੋੜ ਪੈਂਦੀ ਹੀ ਹੈ ਪਾਣੀ ਦੀ ਭਿਰ ਪਾਣੀ ਤੋਂ ਬਿਨਾਂ ਤਾਂ ਅਸੀਂ ਜਿਉਂਦੇ ਵੀ ਨਹੀਂ ਰਹਿ ਸਕਦੇ ਹਾਂ ਕਿਉਂਕਿ ਪਾਣੀ ਦੇ ਬਿਨਾਂ ਤਾਂ ਸਾਡੀ ਕੋਈ ਜ਼ਿੰਦਗੀ ਹੀ ਨਹੀਂ ਹੈ ਪਾਣੀ ਦੀ ਜ ਲੋੜ ਸਾਨੂੰ ਹਰ ਜਗ੍ਹਾ ਪੈਂਦੀ ਹੈ ਵੋਸ਼ਰੂਮ ਵਗੈਰਾ ਜਾਣਾ ਹੋਵੇ ਹੇ ਕ ਕੱਪੜੇ ਧੋਣੇ ਹੋਣ ਉਹਦੇ ਵਿੱਚ ਵੀ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਹਰ ਜਗ੍ਹਾ ਸਾਨੂੰ ਘਰ ਸ਼ੁਰੂ ਤੋਂ ਸੁਬਹ ਤੋਂ ਲੈ ਕੇ ਰਾਤ ਤੱਕ ਸਾਨੂੰ ਪਾਣੀ ਦੀ ਹੀ ਜ਼ਰੂਰਤ ਪੈਂਦੀ ਹੀ ਹੈ ਅਤੇ ਪਾਣੀ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਹਾਂ